ਜੇ ਮੈਂ ਆਪਣੇ ਖ਼ਿਆਲ ਦੇ ਬਾਰੇ ਗੱਲ ਕਰਾਂ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਨਾ ਸਾਡੇ ਉਦਯੋਗਾਂ ਦੇ ਉੱਤੇ ਸਭ ਤੋਂ ਵੱਡੀ ਮਾਰ ਜਿਹੜੀ ਪੈ ਰਹੀ ਹੈ ਨਾ ਇਹ ਜਿਹੜੀ ਥੋੜ੍ਹੀ ਦੇਰ ਬਾਅਦ ਜਿਹੜੀ ਨੋਟਬੰਦੀ ਹੋ ਜਾਂਦੀ ਹੈ ਉਹਦੀ ਮਾਰ ਸਭ ਤੋਂ ਵੱਡੀ ਪੈਂਦੀ ਹੈ ਸਮਝ ਹੀ ਨਹੀਂ ਆਉਂਦੀ ਕਿ ਕਿਹੜਾ ਪੈਸਾ ਕਿੱਥੇ ਲਾਈਏ ਅਤੇ ਆਹ ਜਿਹੜੀ ਜੀ ਐਸ ਟੀ ਇਹਨੇ ਤਾਂ ਹੋਰ ਛੋਟੇ ਛੋਟੇ ਉਦਯੋਗਾਂ ਨੂੰ ਵੀ ਮਾਤ ਦੇ 'ਤੀ ਹੈ